ਮੈਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਕਾਰੋਬਾਰੀ ਨੂੰ ਓਨਲਾਈਨ ਪੇਮੈਂਟ ਕਰਵਾ ਲੈਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ੍ਹ ਵੈਸੇ ਵੀ ਟੈਕਨੋਲੋਜੀ ਦਾ ਸਮਾਂ ਹੈ ਅਤੇ ਲੋਕ ਓਨਲਾਈਨ ਪੇਮੈਂਟ ਕਰਵਾਉਣਾ ਹੀ ਪਸੰਦ ਕਰਦੇ ਹਨ ਓਨਲਾਈਨ ਪੇਮੈਂਟ ਕਰਕੇ ਲੋਕਾਂ ਨੂੰ ਬੈਂਕਾਂ ਦੀ ਲੰਬੀ ਲੰਬੀ ਲਾਈਨਾਂ 'ਚ ਲੱਗਣ ਦੀ ਲੋੜ ਨਹੀਂ ਹੈ ਪੈਸੇ ਕਢਵਾਉਣ ਲਈ ਅਤੇ ਪੈਸੇ ਪਵਾਉਣ ਲਈ ਕਾਫੀ ਸਮਾਂ ਬਚਦਾ ਹੈ ਓਨਲਾਈਨ ਪੇਮੈਂਟ ਨਾਲ ਕਾਫੀ ਸਮਾਂ ਬਚਦਾ ਹੈ ਅਤੇ ਲੋਕਾਂ ਨੂੰ ਕਾਫੀ ਭਾਰੀ ਪੈਸਾ ਨਾਲ ਰੱਖਣ ਦੀ ਲੋੜ ਨਹੀਂ ਹੁੰਦੀ ਹੈ ਇਹਦੇ ਕਾਫੀ ਨੁਕਸਾਨ ਅਤੇ ਫਾਇਦੇ ਹਨ ਮੇਰੇ ਅਨੁਸਾਰ ਇਹਦੇ ਫਾਇਦੇ ਜ਼ਿਆਦਾ ਅਤੇ ਨੁਕਸਾਨ ਘੱਟ ਹਨ ਫਾਇਦੇ ਜਿੱਦਾਂ ਕਿ ਕਾਫੀਆਂ ਦਾ ਸਮਾਂ ਬਚਦਾ ਹੈ ਚੋਰੀ ਚਕਾਰੀ ਘੱਟ ਹੁੰਦੀ ਹੈ ਅਤੇ ਨੁਕਸਾਨ ਇਹ ਹੈ ਕਿ ਕਾਫੀ ਲੋਕ ਹਨ ਜਿਹਨਾਂ ਨੂੰ ਟੈਕਨੋਲਜੀ ਬਾਰੇ ਅੱਜ ਕੱਲ੍ਹ ਨਹੀਂ ਪਤਾ ਹੈ ਅਤੇ ਜੇ ਉਹ ਟੈਕਨੋਲੋਜੀ ਬਾਰੇ ਨਹੀਂ ਸਿੱਖ ਪਾਣਗੇ ਉਹ ਓਨਲਾਈਨ ਪੇਮੈਂਟ ਵੀ ਨਹੀਂ ਕਰ ਪਾਣਗੇ ਮੇਰੇ ਹੀ ਮੇਰੀ ਖਾਸ ਦੋਸਤ ਨਾਲ ਇੱਕ ਅਜਿਹਾ ਕਿ ਕਿੱਸਾ ਹੋਇਆ ਸੀ ਮੇਰੀ ਦੋਸਤ ਕੱਪੜਿਆਂ ਦਾ ਕਾਰੋਬਾਰ ਕਰਦੀ ਹੈ ਉਹਦੇ ਕੋਲ ਇੱਕ ਗ੍ਰਾਹਕ ਆਇਆ ਅਤੇ ਉਹਨੇ ਸਮਾਨ ਲੈ ਕੇ ਆਪਣੇ ਫੋਨ 'ਤੇ ਇੱਦਾਂ ਸ਼ੋਅ ਕੀਤਾ ਜਿੱਦਾਂ ਕਿ ਉਹ ਪੇਮੈਂਟ ਕਰ ਚੁੱਕੀ ਹੈ ਉਹ ਪਰ ਪੇਮੈਂਟ ਹੋਈ ਨਹੀਂ ਸੀ ਉਹ ਆਪਣਾ ਸਮਾਨ ਲੈ ਕੇ ਚਲੀ ਗਈ ਅਤੇ ਮੇਰੀ ਫਰੈਂਡ ਮੇਰੀ ਸਹੇਲੀ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸੀ ਇਸ ਕਰਕੇ ਸਾਨੂੰ ਇਹੋ ਜਿਹੀ ਟੈਕਨੋਲੋਜੀ ਰੱਖਣੀ ਚਾਹੀਦੀ ਹੈ ਜਿਹਦੇ ਨਾਲ ਇੱਕ ਆਵਾਜ਼ ਆ ਜਾਵੇ ਜਦੋਂ ਪੈਸੇ ਸਾਡੇ ਵੱਲ ਟਰਾਂਸਫਰ ਹੋ ਜਾਣ ਧੰਨਵਾਦ